ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀ ਗੱਲ ਕਰੀਏ ਜੇ ਅੱਜ ਕੱਲ੍ਹ ਪਿੰਡਾਂ ਵਿੱਚ ਆਮ ਤੌਰ 'ਤੇ ਨੌਜਵਾਨਾਂ ਵੱਲੋਂ ਵਾਲੀਬਾਲ ਕਬੱਡੀ ਕੁਸ਼ਤੀ ਆਦਿ ਖੇਡਾਂ ਵਿੱਚ ਭਾਗ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਪਿੰਡਾਂ ਵਿੱਚ ਪੁਰਾਣੀਆਂ ਖੇਡਾਂ ਖੋ ਖੋ ਪਿੱਠੂ ਆਦਿ ਸਮੇਂ ਦੇ ਨਾਲ ਨਾਲ ਅਲੋਪ ਹੋ ਰਹੀਆਂ ਹਨ ਪਿੰਡਾਂ ਵਿੱਚ ਰੋਜ਼ਾਨਾ ਹੀ ਸ਼ਾਮ ਨੂੰ ਨੌਜਵਾਨ ਕਬੱਡੀ ਅਤੇ ਵਾਲੀਬਾਲ ਆਦਿ ਖੇਡਾਂ ਖੇਡਦੇ ਹਨ ਅਤੇ ਕਈ ਪਿੰਡਾਂ ਵਿੱਚ ਟੂਰਨਾਮੈਂਟ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਅਤੇ ਜਿਸ ਨਾਲ ਖਿਡ ਖਿਡਾਰੀ ਨੂੰ ਹੋਰ ਵੀ ਪ੍ਰਸ਼ੰਸਾ ਮਿਲਦੀ ਹੈ ਆਧੁਨਿਕ ਸਹੂਲਤ ਤਾਂ ਦੀ ਘਾਟ ਹੋਣ ਕਾਰਣ ਕਈ ਵਾਰ ਫਸਲ ਕੱਟਣ ਉਪਰੰਤ ਖਾਲੀ ਖੇਤਾਂ ਵਿੱਚ ਵੀ ਕ੍ਰਿਕਟ ਅਤੇ ਕਬੱਡੀ ਦੇ ਮੈਚਾਂ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਕੁਸ਼ਤੀ ਅਤੇ ਵੇਟ ਲਿਫਟਿੰਗ ਆਦਿ ਪਿੰਡਾਂ ਦੀਆਂ ਪ੍ਰਸਿੱਧ ਖੇਡਾਂ ਹਨ ਜੇਕਰ ਹੁਣ ਗੱਲ ਕਰੀਏ ਆਪਾਂ ਸ਼ਹਿਰੀ ਖੇਤਰਾਂ ਦੀ ਤਾਂ ਉੱਥੇ ਕ੍ਰਿਕਟ ਬੈਡਮਿੰਟਨ ਬਾਸਟਿਕਬਾ ਬਾ ਬਾਸਕਿਟਬਾਲ ਹੈਂਡਬੋਲ ਅਤੇ ਫੁੱਟਬਾਲ ਆਦਿ ਖੇਡਾਂ ਖੇਡੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਜਿੱਥੇ ਸਹੂਲਤਾਂ ਵਧੀਆ ਮਿਲਦੀਆਂ ਹਨ ਉੱਥੇ ਸਵੀਮਿੰਗ ਪੂਲ ਆਦਿ ਵਿੱਚ ਵੀ ਭਾਗ ਲਿਆ ਜਾਂਦਾ ਹੈ ਸ਼ਹਿਰਾਂ ਵਿੱਚ ਰੋਜ਼ਾਨਾ ਦੀ ਬਜਾਏ ਛੁੱਟੀ ਵਾਲੇ ਦਿਨ ਐਤਵਾਰ ਨੂੰ ਨੌਜਵਾਨ ਵੱਲੋਂ ਕ੍ਰਿਕਟਾ ਕ੍ਰਿਕਟ ਦੇ ਮੈਚਾਂ ਵਿੱਚ ਭਾਗ ਲਿਆ ਜਾਂਦਾ ਹੈ ਆਧੁਨਿਕ ਸਮੇਂ ਵਿੱਚ ਵਿੱਚ ਮਿਲਣ ਕਾਰਣ ਪਿੰਡਾਂ ਅਤੇ ਸ਼ਹਿਰਾਂ ਦੀਆਂ ਖੇਡਾਂ ਵਿੱਚ ਕੋਈ ਖ਼ਾਸ ਫ਼ਰਕ ਨਹੀਂ ਰਹਿ ਗਿਆ ਓਕੇ ਜੀ ਧੰਨਵਾਦ